ਬਿਜਲੀ ਘਰ ਵਿੱਚ ਚੌਵੀ ਘੰਟੇ ਵਿੱਚੋਂ ਸਿਰਫ਼ ਅੱਠ ਘੰਟੇ ਆਉਂਦੀ ਹੈ ਵੱਖ ਵੱਖ ਮੌਸਮ ਦੱਸੀਏ ਤਾਂ ਮੌਸਮ ਹਨੇਰੀ ਆਵੇ ਬਿਜਲੀ ਕੱਟ ਮੀਂਹ ਆਵੇ ਬਿਜਲੀ ਕੱਟ ਬਿਜਲੀ ਬਹੁਤ ਹੀ ਘੱਟ ਆਉਂਦੀ ਹੈ ਕੱਟ ਲੱਗਦੇ ਨੇ ਸਰਦੀਆਂ ਵਿੱਚ ਵੀ ਬਹੁਤ ਜ਼ਿਆਦਾ ਕੱਟ ਲੱਗਦੇ ਨੇ ਬਿਜਲੀ ਤੋਂ ਪਰੇਸ਼ਾਨ ਬਹੁਤ ਹੁੰਦੇ ਹਾਂ ਗਰਮੀਆਂ ਵਿੱਚ ਏ ਸੀ ਚੱਲਦੇ ਨੇ ਮੋਟਰ ਚੱਲਦੇ ਨੇ ਫਰਿੱਜ਼ ਚੱਲਦੀ ਹੈ ਪੰਖੇ ਚੱਲਦੇ ਨੇ ਜਿਸ ਕਰਕੇ ਬਿਜਲੀ ਕਈ ਵਾਰ ਬਹੁਤ ਘੱਟ ਆਉਂਦੀ ਹੈ ਜ਼ਿਆਦਾ ਚੀਜ਼ਾਂ ਚੱਲਣ ਨਾਲ ਕਈ ਵਾਰ ਬਿਜਲੀ ਦਾ ਟ੍ਰਾਂਫਾਰਮ ਵੀ ਸੜ ਜਾਂਦਾ ਹੈ ਜਿਸ ਕਰਕੇ ਸਾਨੂੰ ਬਿਜਲੀ ਤੋਂ ਤਿੰਨ ਤਿੰਨ ਦਿਨ ਪ੍ਰੇਸ਼ਾਨੀ ਹੁੰਦੀ ਹੈ ਮੌਸਮ ਖ਼ਰਾਬ ਹੋ ਜਾਂਦਾ ਤਾਂ ਤਾਰਾਂ ਡਿੱਗ ਜਾਂਦੀਆਂ ਨੇ ਇਸ ਕਰਕੇ ਵੀ ਸਾਨੂੰ ਬਿਜਲੀ ਤੋਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ